ਮੈਨੂੰ ਨਵੇਂ ਨਵੇਂ ਲੋਕਾਂ ਨਾਲ਼ ਮਿੱਤਰਤਾ ਕਰਨੀ ਬਹੁਤ ਪਸੰਦ ਹੈ ਜਿਸ ਨਾਲ਼ ਕਿ ਮੈਂ ਕਈ ਤਰ੍ਹਾਂ ਦੇ ਲੋਕਾਂ ਨਾਲ਼ ਮਿਲਦਾ ਹਾਂ ਜਿਸ ਨਾਲ਼ ਮੈਨੂੰ ਉਹਨਾਂ ਦੇ ਰਹਿਣ ਸਹਿਣ ਖਾਣ ਪੀਣ ਅਤੇ ਨੇਚਰ ਦਾ ਪਤਾ ਲੱਗਦਾ ਹੈ ਉਹ ਕਿਵੇਂ ਦੇ ਮਾਹੌਲ ਵਿੱਚ ਰਹਿੰਦੇ ਹਨ ਅਤੇ ਕਿਵੇਂ ਦੀ ਉਹਨਾਂ ਦੀ ਸਿੱਖਿਆ ਹੈ ਅਤੇ ਕੀ ਕੁਛ ਉਹਨਾਂ ਕੋਲੋਂ ਸਿੱਖਣ ਨੂੰ ਮਿਲਦਾ ਹੈ ਇਸ ਚੀਜ਼ ਦਾ ਮੈਨੂੰ ਨਵੇਂ ਨਵੇਂ ਲੋਕਾਂ ਨਾਲ਼ ਮਿਲ ਕੇ ਜਾਣਕਾਰੀ ਹੁੰਦੀ ਹੈ ਅਤੇ ਮੈਂ ਉਹਨਾਂ ਨਾਲ਼ ਆਪਣੀ ਵੀ ਜਾਣਕਾਰੀ ਸਾਂਝੀ ਕਰਦਾ ਹਾਂ ਕਿ ਕਿਵੇਂ ਦੇ ਮਾਹੌਲ ਵਿੱਚ ਅਸੀਂ ਰਹਿੰਦੇ ਹਾਂ ਅਤੇ ਉਹ ਮੈਨੂੰ ਆਪਣੇ ਬਾਰੇ ਵੀ ਦੱਸਦੇ ਹਨ ਕਿ ਕਿਵੇਂ ਦਾ ਰਹਿਣਾ ਸਹਿਣਾ ਅਤੇ ਖਾਣਾ ਪੀਣਾ ਉਹਨਾਂ ਦਾ ਹੈ ਅਤੇ ਉਹ ਕਿਵੇਂ ਦੇ ਮਾਹੌਲ ਵਿੱਚ ਰਹਿੰਦੇ ਹਨ